ਭਾਰਤ ਦੇ ਫੈਸ਼ਨ ਟਾਈਮ ਦੇ ਅਨੁਸਾਰ ਬਦਲ ਗਿਆ ਹੈ ਕੁਛ ਟਾਈਮ ਪਹਿਲਾਂ ਪੰਜਾਬ ਦੇ ਵਿੱਚ ਸੂਟ ਸਲਵਾਰ ਇਹਨਾਂ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਅਤੇ ਬੰਦੇ ਕੁੜਤੇ ਪਜਾਮੇ ਹੁਣ ਟਾਈਮ ਦੇ ਹਿਸਾਬ ਨਾਲ ਫੈਸ਼ਨ ਦੇ ਹਿਸਾਬ ਨਾਲ ਪੱਛਮੀ ਫੈਸ਼ਨ ਕਿਉਂਕਿ ਭ ਭਾ ਭਾਰਤ ਦੇ ਪੰਜਾਬ ਦੇ ਜ਼ਿਆਦਾਤਰ ਇਲਾਕੇ ਦੇ ਲੋਕ ਸਾਰੇ ਵਿਸ਼ਵ ਵਿੱਚ ਫੈਲੇ ਹੋਏ ਆ ਅਤੇ ਉੱਥੇ ਦੇ ਫੈਸ਼ਨ ਇੱਥੇ ਵੀ ਆ ਕੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਹੁਣ ਸਲਵਾਰ ਸੂਟ ਕੁੜਤਾ ਪਜਾਮਾ ਇਹ ਆਮ ਘਰਾਂ 'ਚ ਹੀ ਪਾਇਆ ਜਾ ਸਕਦਾ ਪਰ ਬਾਹਰ ਜਿਹੜੇ ਆ ਉਹ ਪੈਂਟ ਸ਼ਰਟ ਟੀ ਸ਼ਰਟ ਇਹ ਚੀਜ਼ਾਂ ਹੀ ਪਾ ਕੇ ਪਾ ਕੇ ਆਪਣਾ ਜਿਹੜਾ ਹੈ ਫੈਸ਼ਨ ਜਿਹੜਾ ਆ ਇਹਨੂੰ ਬੜਾਵਾ ਦੇ ਦਿੱਤਾ ਜਾ ਰਿਹਾ ਅਤੇ ਮੈਂ ਫੈਸ਼ਨ ਤੋਂ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਪਹਿਲਾਂ ਜਿੱਦਾਂ ਕੁੜਤਾ ਪਜਾਮਾ ਘਰ 'ਚ ਪਾ ਲੈਣਾ ਅਤੇ ਬਾਹਰ ਪੈਂਟ ਕਮੀਜ਼ ਦਫ਼ਤਰ ਕੋਲਜ ਜਾਣਾ ਤਾਂ ਉਹਦੇ ਹਿਸਾਬ ਨਾਲ ਪੈਂਟ ਕਮੀਜ਼ ਫੋਰਮਲ ਕੱਪੜੇ ਪਾਣੇ ਪੈਂਦੇ ਆ ਇਹ ਮੈਂ ਕੱਪੜੇ ਜਿਹੜੇ ਆ ਵੀ ਪੈਂਟ ਕਮੀਜ਼ ਜਿੱਦਾਂ ਹੁਣ ਅ ਮੋਲ 'ਚੋਂ ਵੀ ਖਰੀਦ ਲਈਦੀ ਆ ਅਤੇ ਇੱਕ ਦੁਕਾਨ ਆ ਮੈਂ ਟੇਲਰ ਉਹ ਮੇਰੇ ਕੋਲ ਬਹੁਤ ਪੁਰਾਣਾ ਮੈਂ ਉਨ੍ਹਾਂ ਕੋਲ ਖਰੀਦ ਰਿਹਾ ਕਾਫੀ ਟਾਈਮ ਸਮਾਨ ਇਹਨਾਂ ਦੇ ਕੋਲੋਂ ਅਤੇ ਇਹਨਾਂ ਦੇ ਮੈਨੂੰ ਰੇਟ ਵੀ ਸਹੀ ਹੁੰਦੇ ਜਾਇਜ਼ ਵੀ ਸਹੀ ਆ ਅਤੇ ਮੈਂ ਜੇ ਥੋੜ੍ਹਾ ਫੈਸ਼ਨ ਬਦਲਣਾ ਚਾਹਵਾਂ ਤਾਂ ਮੋਲ ਵੀ ਚਲ ਜਾਈਦਾ ਆ ਅਤੇ ਵੈਸੇ ਕੁੜਤਾ ਪਜਾਮਾ ਹੀ ਜ਼ਿਆਦਾਤਰ ਘਰਾਂ 'ਚ ਪਾਇਆ ਜਾਂਦਾ ਅਤੇ ਹੀ ਜੁੱਤੀ ਵੀ ਨੋਰਮਲੀ 'ਤੇ ਕੋਈ ਜ਼ਿਆਦਾ ਨਹੀਂ ਫੈਸ਼ਨ ਕਰਨ ਦੀ ਹੈਗੀ ਉਮਰ ਦੇ ਹਿਸਾਬ ਨਾਲ ਫੈਸ਼ਨ ਵੀ ਠੀਕ ਨਹੀਂ ਲੱਗਦਾ